ਹਾਂ ਮੈਨੂੰ ਲੱਗਦਾ ਹੈ ਕਿ ਨਵੀਂ ਟੈਕਨੋਲਜੀ ਦੇ ਆਉਣ ਨਾਲ ਕਈ ਦਾ ਰੁਜ਼ਗਾਰ ਚਲਾ ਜਾਵੇਗਾ ਇਹ ਇੱਕ ਅਜਿਹਾ ਮੁੱਦਾ ਹੈ ਜਿਸ ਬਾਰੇ ਬਹੁਤ ਚਰਚਾ ਹੋ ਰਹੀ ਹੈ ਹਾਲਾਂਕਿ ਇਹ ਵੀ ਸੱਚ ਹੈ ਕਿ ਨਵੀਂ ਟੈ ਟੈਕਨੋਲੋਜੀ ਨਵੀਆਂ ਨੌਕਰੀਆਂ ਵੀ ਪੈਦਾ ਕਰ ਰਹੇ ਕ ਕਰੇਗੀ ਉਦਾਹਰਣ ਵਜੋਂ ਨਹੀਂ ਨਵੀਂ ਟੈਕਨੋਲਜੀ ਨੂੰ ਵਿਕ ਵਿਕਸਿਤ ਕਰਨ ਲਾਗੂ ਕਰਨ ਕਰਨਾ ਅਤੇ ਸੰਚਾਲਚ ਕਰਨ ਲਈ ਲਈ ਲੋਕਾਂ ਦੀ ਵੀ ਲੋੜ ਹੋਵੇਗੀ ਜਿਵ ਇਸ ਦੇ ਇਲਾਵਾ ਸਰਕਾਰੀ ਅਤੇ ਕਾਰਬੋ ਕਰਬਾ ਨੂੰ ਇਹ ਯਕੀਨ ਬਣਾਉਣ ਲਈ ਮਿਲ ਕੇ ਕੰਮ ਕਰਨਾ ਦੀ ਲੋੜ ਹੈਗੀ ਹੈ ਧੰਨਵਾਦ